ਖੇਡਾਂ ਲੋਕਾਂ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ ਖੇਡਾਂ ਨਾਲ ਖੇਡਾਂ ਖੇਡਣ ਨਾਲ ਬਹੁਤ ਹੀ ਜ਼ਿਆਦਾ ਫ਼ਾਇਦੇ ਹੁੰਦੇ ਹਨ ਸਾਡੀ ਜ਼ਿੰਦਗੀ ਵਿੱਚ ਜੇ ਅਸੀਂ ਖੇਡਾਂ ਖੇਡਾਂਗੇ ਤਾਂ ਸਾਡੀ ਲਾਈਫ ਹੀ ਬਦਲ ਜਾਏਗੀ ਲਾਈਫ ਸਟਾਈਲ ਹੀ ਬਦਲ ਜਾਂਦਾ ਹੈ ਖੇਡਾਂ ਖੇਡਣ ਨਾਲ ਮੈਂਟਲੀ ਵੀ ਔਰ ਫਿਜ਼ੀਕਲੀ ਵੀ ਖੇਡਾਂ ਜਦੋਂ ਆਪਾਂ ਖੇਡਦੇ ਹੈ ਜੇ ਸਾਨੂੰ ਦੂਜੇ ਲੋਕ ਵੀ ਦੇਖਣ ਉਹਨਾਂ ਦਾ ਵੀ ਮਨ ਕਰਦਾ ਵਾ ਖੇਡਾਂ ਖੇਡਣ ਦਾ ਇਸ ਨਾਲ ਵੀ ਬਹੁਤ ਫ਼ਾਇਦਾ ਹੁੰਦਾ ਦੂਜਿਆਂ ਦਾ ਵੀ ਅਤੇ ਆਪਣਾ ਵੀ ਖੇਡਾਂ ਖੇਡਦੇ ਆਪਾਂ ਬਹੁਤ ਲੈਵਲ ਤੱਕ ਅੱਗੇ ਵੀ ਜਾ ਸਕਦੇ ਹਾਂ ਸਾਨੂੰ ਬਹੁਤ ਫ਼ਾਇਦਾ ਹੁੰਦਾ ਵਾ ਸਟੇਟ ਲੈਵਲ ਇੰਟਰਨੈਸ਼ਨਲ ਲੈਵਲ ਕਦੇ ਵੀ ਆਪਾਂ ਕੁਛ ਵੀ ਬਣ ਸਕਦੇ ਹਾਂ ਸਾਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਵਾ ਖੇਡਾਂ ਖੇਡਣ ਨਾਲ ਫਿਜ਼ੀਕਲੀ ਮੈਂਟਲੀ ਬੰਦਾ ਸ਼ਾਰਪ ਰਹਿੰਦਾ ਹੈ ਔਰ ਉਨ੍ਹਾਂ ਦਾ ਮਾਈਂਡ ਵੀ ਸ਼ਾਰਪ ਰਹਿੰਦਾ ਵਾ ਖੇਡਾਂ ਖੇਡਣ ਨਾਲ ਉਨ੍ਹਾਂ ਦਾ ਇੱਕੋ ਹੀ ਮਾਈਂਡ ਸੈੱਟ ਹੁੰਦਾ ਵਾ ਗੋਲ ਹੁੰਦਾ ਵਾ ਕਿ ਆਪਾਂ ਇਹ ਹੀ ਜਿੱਤਣਾ ਔਰ ਕਰਨਾ ਹੀ ਆ ਉਨ੍ਹਾਂ ਦਾ ਡਿਵਰਟ ਨਹੀਂ ਹੁੰਦਾ ਮਾਈਂਡ ਇੱਕੋਂ ਹੀ ਪਾਸੇ ਲੱਗਿਆ ਰਹਿੰਦਾ ਵਾ ਅਤੇ ਖੇਡਾਂ ਖੇਡਣ ਨਾਲ ਬੰਦਾ ਬਹੁਤ ਹੀ ਅੱਗੇ ਵੱਧਦਾ ਉਨ੍ਹਾਂ ਦੀ ਹਾਈਟ ਵਧਦੀ ਆ ਫਿਜ਼ੀਕਲੀ ਫਿੱਟ ਹੋ ਜਾਂਦੇ ਉਹ ਇੱਕ ਦਮ ਔਰ ਉਨ੍ਹਾਂ ਨੂੰ ਕੋਈ ਚੀਜ਼ ਦੀ ਹੋਰ ਲੋੜ ਹੀ ਨਹੀਂ ਹੈਗੀ ਕਿ ਪ੍ਰੋਟੀਨ ਵਗੈਰਾ ਖਾਣ ਦੀ ਕੁਛ ਨਹੀਂ ਉਨ੍ਹਾਂ ਨੂੰ ਬਸ ਖੇਡਣਾ ਹੀ ਬਹੁਤ ਬੇਨੀਫਿਸ਼ਿਅਲ ਹੁੰਦੇ ਨੇ